ਹਾਂਜੀ ਜਿਹੜੀ ਸਰਕਾਰੀ ਸਕੂਲਾਂ 'ਚ ਮਿਡ ਡੇ ਸਕੀਮ ਚੱਲ ਰਹੀ ਹੈ ਵਧੀਆ ਸਕੀਮ ਹੈ ਉਹ ਗਰੀਬ ਬੱਚਿਆਂ ਲਈ ਨਹੀਂ ਤਾਂ ਇੰਨੀ ਭੁੱਖਮਰੀ ਹੋਈ ਪਈ ਹੈ ਭਾਰਤ 'ਚ ਕਿ ਬੰਦੇ ਨੂੰ ਦੋ ਵਕਤ ਦਾ ਖਾਣਾ ਵੀ ਨਹੀਂ ਮਿਲਦਾ ਸਕੂਲ 'ਚ ਪੜ੍ਹਾਉਣ ਬਾਰੇ ਤਾਂ ਮਾਂ ਪਿਓ ਸੋਚਦੇ ਹੀ ਨਹੀਂ ਸਰਕਾਰੀ ਸਕੂਲਾਂ 'ਚ ਫੀਸ ਘੱਟ ਹੁੰਦੀ ਹੈ ਤਾਂ ਇਸ ਕਰਕੇ ਗਰੀਬ ਬੰਦਾ ਵੀ ਆਪਣੇ ਬੱਚੇ ਨੂੰ ਸਕੂਲ 'ਚ ਪੜ੍ਹਾ ਦਿੰਦਾ ਅਤੇ ਇੱਕ ਇਹ ਵੀ ਸੋਚ ਲੈਂਦਾ ਵੀ ਚਲੋ ਉੱਥੇ ਖਾਣਾ ਵੀ ਮਿਲ ਜਾਊਗਾ ਅਤੇ ਉਹ ਖਾਣਾ ਵੀ ਪੌਸ਼ਟਿਕ ਹੁੰਦਾ ਨਹੀਂ ਕਈ ਬੱਚੇ ਕੁਪੋਸ਼ਣ ਦਾ ਸ਼ਿਕਾਰ ਇਸੇ ਕਰਕੇ ਹੀ ਹੁੰਦੇ ਆ ਕਿਉਂਕਿ ਉਹਨਾਂ ਨੂੰ ਪੌਸ਼ਟਿਕ ਖਾਣਾ ਨਹੀਂ ਮਿਲਦਾ ਸਕੂਲ 'ਚ ਬੱਚਿਆਂ ਨੂੰ ਵਧੀਆ ਖਾਣਾ ਮਿਲ ਜਾਂਦਾ ਹੈਗਾ ਅਤੇ ਚਲੋ ਬੱਚਿਆਂ ਦੀ ਇਨਰੋਲਮੈਂਟ ਹੋ ਜਾਂਦੀ ਹੈ ਬੱਚੇ ਪੜ੍ਹ ਵੀ ਲੈਂਦੇ ਹੈਗੇ ਅਤੇ ਖਾਣਾ ਸਕੂਲ 'ਚ ਵਧੀਆ ਕੁਆਲਿਟੀ ਦਾ ਪ੍ਰੋਵਾਈਡ ਕਰਵਾਇਆ ਜਾਂਦਾ ਬੱਚਿਆਂ ਨੂੰ ਕੋਈ ਇਹ ਨਹੀਂ ਵੀ ਗੰਦਾ ਖਾਣਾ ਜਾਂ ਸਸਤਾ ਖਾਣਾ ਬੱਚਿਆਂ ਨੂੰ ਸਮੇਂ ਸਮੇਂ 'ਤੇ ਸਕੂਲ 'ਚ ਟੀਮਾਂ ਆ ਕੇ ਖਾਣਾ ਮਿੱਡ ਡੇ ਮੀਲ ਵਾਲਾ ਚੈੱਕ ਵੀ ਕਰਦੀਆਂ ਕਿ ਖਾਣਾ ਬੱਚਿਆਂ ਨੂੰ ਸਹੀ ਮਿਲ ਵੀ ਰਿਹਾ ਜਾਂ ਨਹੀਂ ਇਹਦਾ ਪ੍ਰੋਪਰ ਰਿਕਾਰਡ ਸਕੂਲਾਂ 'ਚ ਰੱਖਿਆ ਜਾਂਦਾ ਕਿ ਕੀ ਖਾਣਾ ਆਇਆ ਉੱਥੇ ਜਾਂ ਕੀ ਨਹੀਂ ਆਇਆ ਹੈਗਾ